ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਸਰ ਦੱਸੋ ਕਿੱਦਾਂ ਹੈਲਪ ਕਰ ਸਕਦੇ ਹਾਂ ਅਸੀਂ ਤੁਹਾਡੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ

ਹਾਂਜੀ ਹਾਂਜੀ ਸਰ ਹਾਂਜੀ ਤੁਸੀਂ ਦੱਸੋ ਜਿਹੜਾ ਤੁਹਾਡਾ ਸਿਸਟਮ ਹੈ ਤੁਸੀਂ ਸੀਪੀਯੂ ਤੋਂ ਓਨ ਕਰਕੇ ਉਹਨੂੰ ਮੇਨ ਤੋਂ ਓਨ ਕਰ ਰਹੇ ਹੋ ਅਤੇ ਵੈਸੇ ਇਹ ਤੁਸੀਂ ਪ੍ਰੋਬਲਮ ਸਾਡੇ ਕੋਲ ਪਹਿਲਾਂ ਹੀ ਲੈ ਕੇ ਆਉਣੀ ਸੀਗੀ ਅਤੇ ਜੇ ਹੁਣ ਤੁਸੀਂ ਕੋਈ ਗੱਲ ਨਹੀਂ ਅੱਛਾ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਜੀ ਕੋਈ ਗੱਲ ਨਹੀਂ ਸਰ ਤੁਸੀਂ ਇਹਦੇ ਵਿੱਚ ਇੱਕ ਨਾ ਬੂਟਿੰਗ ਪ੍ਰੋਸੈਸ ਹੁੰਦਾ ਹੈਗਾ ਅਤੇ ਤੁਸੀਂ ਉਹਨੂੰ ਇੱਕ ਵਾਰੀ ਜਿਹੜਾ ਮੇਨ ਦੋ ਬੰਦ ਕਰਕੇ ਉਹਨੂੰ ਦੁਬਾਰਾ ਜਿਹੜਾ ਉਹਦਾ ਮੇਨ ਬਟਨ ਹੈਗਾ ਉਹਨੂੰ ਦੁਬਾਰਾ ਰੀਸਟਾਰਟ ਕਰਨ ਦੀ ਕੋਸ਼ਿਸ਼ ਕਰੋ ਅਤੇ ਉਹਨੂੰ ਬਟਨ ਨੂੰ ਦੱਬ ਕੇ ਰੱਖਣਾ ਅਤੇ ਫਿਰ ਉਹਨੂੰ ਦੇਖੋ ਕੇ ਉਹ ਚੱਲਦਾ ਹੈ ਕਿ ਨਹੀਂ ਚੱਲਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉੱਥੇ ਸਰ ਜਿਹੜਾ ਓਨ ਹੈਗਾ ਉਹਨੂੰ ਤੁਸੀਂ ਮੇਨ ਤੋਂ ਦੁਬਾਰਾ ਡਬਲ ਕਲਿੱਕ ਕਰਨ ਦੀ ਬਜਾਏ ਤੁਸੀਂ ਉਹਨੂੰ ਇੱਕ ਵਾਰੀ ਦੱਬ ਕੇ ਰੱਖਣਾ ਫਿਰ ਤੁਸੀਂ ਓਨ ਕਰਕੇ ਦੇਖੋ ਜੇ ਉਹਦੇ ਵਿੱਚ ਲਾਈਟ ਆਉਂਦੀ ਹੈ ਤਾਂ ਫੇਰ ਤੁਹਾਡੇ ਕੋਲ ਉਹਦੇ ਵਿੱਚ ਇੱਕ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਟੈਨ ਸੈਕਿੰਡਸ ਜਰਾ ਪ੍ਰੈਸ ਕਰਕੇ ਰੱਖੋ ਬਟਨ ਓਨ ਹੋਜੇਗਾ ਫਿਰ ਜਿਹੜੀ ਲਾਈਟ ਆਏਗੀ ਹਾਂਜੀ ਹਾਂਜੀ ਦੋਖੇ ਲਾਈਟ ਆਈ ਹੋਏਗੀ ਇੱਕ ਸਕਰੀਨ 'ਤੇ ਸ਼ੋਅ ਹੋਣ ਲੱਗ ਗੀ ਹੋਏਗੀ ਕੋਡਿੰਗ ਹਾਂਜੀ ਹਾਂਜੀ

ਸਰ ਉਹ ਆਏਗਾ ਉਹਦੇ 'ਤੇ ਇੱਕ ਉਹਦੇ 'ਤੇ ਇੱਕ ਕੋਡਿੰਗ ਸ਼ੋਅ ਹੋਏਗੀ ਅਤੇ ਉਹਦੇ 'ਤੇ ਲਿਖਿਆ ਆਏਗਾ ਕੰਟੀਨਿਊ ਵਿਦ ਐੱਫ ਵਨ ਔਰ ਐੱਫ ਟੂ ਨਹੀਂ ਨਹੀਂ ਸਰ ਆਏ ਹਾਂਜੀ ਹਾਂਜੀ ਹਾਂਜੀ ਹਾਂਜੀ ਇਹਦੇ ਵਿੱਚ ਹਾਂਜੀ ਹਾਂਜੀ ਹਾਂਜੀ ਆ ਗਿਆ ਸਰ ਦੇਖੋ ਇਹਦੇ ਵਿੱਚ ਇੱਕ ਕੋਡਿੰਗ ਸ਼ੁਰੂ ਹੋਜੇਗੀ ਉਹਦੇ ਵਿੱਚ ਐਂਟਰ ਲਿਖਿਆ ਆਏਗਾ ਕੰਟੀਨਿਊ ਵਿਦ ਐੱਫ ਵਨ ਆਏਗਾ ਅਤੇ ਇੱਦਾਂ ਕੁਛ ਲਿਖਿਆ ਆਏਗਾ ਅਤੇ ਜੇ ਕੰਟੀਨਿਊ ਵਿਦ ਐੱਫ ਵਨ ਆਏਗਾ ਤਾਂ ਤੁਸੀਂ ਵਨ ਪ੍ਰੈਸ ਕਰਕੇ ਤੁਸੀਂ ਐਂਟਰ ਕਰ ਦੇਣਾ ਹਾਂਜੀ ਹਾਂਜੀ ਸਰ ਉਹ ਉਸ ਤੋਂ ਬਾਅਦ ਤੁਸੀਂ ਦੇਖੋ ਤੁਸੀਂ ਤੁਹਾਡੀ ਜਿਹੜੀ ਵਿੰਡੋ ਹੈ ਉਹ ਤੁਸੀਂ ਪ੍ਰੋਸੈਸਿੰਗ ਦੇ ਨਾਲ ਦੋ ਮਿਨਟ ਲਏਗਾ ਇਹ ਹਾਂਜੀ ਹਾਂਜੀ ਪ੍ਰੋਸੈਸਿੰਗ ਹਾਂਜੀ ਹਾਂਜੀ ਇਹ ਪ੍ਰੋਸੈਸਿੰਗ ਦੇ ਨਾਲ ਨਾਲ ਹੀ ਸਰ ਦੋ ਕ ਮਿੰਟ ਲੈ ਕੇ ਇਹ ਫਿਰ ਤੁਹਾਡਾ ਇਹ ਜਿਹੜਾ ਸਿਸਟਮ ਹੈ ਉਹ ਓਨ ਹੋਜੇਗਾ ਤੁਸੀਂ ਵਿੰਡੋ ਦੇ ਵਿੱਚ ਚਲੇ ਜਾਓਗੇ ਬਾਕੀ ਜਿਹੜੀ ਇਹਦੀ ਮੇਨ ਪ੍ਰੋਬਲਮ ਹੈਗੀ ਹੈ ਉਹ ਤੁਸੀਂ ਇੱਕ ਵਾਰੀ ਇਹਨੂੰ ਸਿਸਟਮ ਨੂੰ ਸਾਡੀ ਸ਼ੋਪ 'ਤੇ ਲੈ ਆਇਓ ਅਤੇ ਅਸੀਂ ਇੱਕ ਵਾਰੀ ਇਹਨੂੰ ਚੈੱਕ ਕਰਕੇ ਇਹਨੂੰ ਅਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਮੋਸਟ ਵੈਲਕਮ ਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਨਹੀਂ ਨਹੀਂ ਸਰ ਬਹੁਤ ਬਹੁਤ ਹਾਂਜੀ ਹਾਂਜੀ ਸਾਡੀ ਰਿਕਮੈਂਡੇਸ਼ਨ ਦੇਣ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਅਸੀਂ ਆਪਣੇ ਕਸਟਮਰ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿੰਦੇ ਹਾਂ ਥੈਂਕ ਯੂ ਜੀ ਠੀਕ ਐ ਜੀ ਓਕੇ ਸਰ ਧੰਨਵਾਦ ਤੁਹਾਡਾ ਦਿਨ ਸ਼ੁਭ ਹੋਵੇ ਓਕੇ ਜੀ